ਭੰਗੜਾ ਐਰੋਬਿਕਸ ਫਿਟਨੈਸ ਦੀ ਦੁਨੀਆਂ ਵਿੱਚ ਇੱਕ ਬਹੁਤ ਵੱਡਾ ਹਿੱਸਾ ਰੱਖਦੇ ਹਨ ਜਦੋਂ ਜਿਹੜਾ ਇਨਸਾਨ ਭੰਗੜਾ ਕਰਦਾ ਹੈ ਉਹਦਾ ਪੂਰਾ ਸਰੀਰ ਵੀ ਸ਼ਾਂਤ ਰਹਿੰਦਾ ਹੈ ਉਹ ਪੂਰਾ ਇੰਜੋਏ ਕਰ ਸਕਦਾ ਹੈ ਕਿਸੇ ਵੀ ਚੀਜ਼ ਨੂੰ ਉਹ ਜਦੋਂ ਤੱਕ ਉਹ ਅੰਦਰੋਂ ਖੁਸ਼ ਹੁੰਦਾ ਹੋਏਗਾ ਉਹ ਬਾ ਬਾਹਰੋਂ ਉਹ ਖੁਸ਼ ਤਾਂ ਹੀ ਹੋ ਸਕਦਾ ਹੈ ਜੇ ਉਹ ਖੁ ਅੰਦਰੋਂ ਖੁਸ਼ ਹੋਏਗਾ ਜਦੋਂ ਅਸੀਂ ਨੱਚਦੇ ਹਾਂ ਅਸੀਂ ਡਾਂਸ ਕਰਦੇ ਹਾਂ ਸਾਡੇ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ ਜਿਸ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਅਸੀਂ ਲੋਕਾਂ ਨੂੰ ਚਾਹੁੰਦੇ ਆ ਕਿ ਅਸੀਂ ਹੋਰ ਵੀ ਲੋਕੀ ਨੂੰ ਭੰਗੜੇ ਨੂੰ ਨੂੰ ਜੁਆਇਨ ਕਰਨ ਆਉਣ ਸਾਰੇ ਸਿੱਖਣ ਸਾਰੇ ਕਰਨ ਵੱਡੇ ਤੋਂ ਛੋਟਾ ਸਾਰੇ ਜਾਣੇ ਐਰੋਬਿਕਸ ਕਰਨ ਜਿਹਦੇ ਨਾਲ ਕਿ ਸਾਰਿਆਂ ਦਾ ਸਰੀਰ ਬਿਲਕੁਲ ਠੀਕ ਰਵੇ ਜਦੋਂ ਜੇ ਸਰੀਰ ਠੀਕ ਹੋਏ ਤਾਂ ਹੀ ਕੁਛ ਕਰ ਸਕਦੇ ਹਾਂ ਸਰੀਰ ਨਾਲ ਅਕੋਂ ਸਰੀਰ ਨੂੰ ਲੈ ਕੇ ਅਸੀਂ ਜੋ ਵੀ ਕਰ ਸਕਦੇ ਹਾਂ ਨਹੀਂ ਤਾਂ ਫਿਰ ਬਾਅਦ ਤਾਂ ਫਿਰ ਤਾਂ ਦਵਾਈਆਂ ਨਾਲੋਂ ਤਾਂ ਬੈਟਰ ਹੈ ਵੀ ਜੇ ਅਸੀਂ ਆਪਣੇ ਸਰੀਰ ਨੂੰ ਕਰਾ ਸਕੀਏ ਡਾਂਸ ਕਰਾ ਸਕੀਏ ਐਕਸਰਸਾਈਜ਼ ਕਰਾ ਸਕੀਏ ਔਰੋਬਿਕਸ ਕਰਵਾ ਸਕੀਏ ਔਰੋਬਿਕਸ ਨਾਲ ਸਾਡਾ ਪੂਰਾ ਸਰੀਰ ਮੋਢੇ ਗਰਦਨ ਹੱਥ ਬਾਵਾਂ ਲੱਤਾਂ ਪਿੱਠ ਪੈਰ ਸਿਰ ਹਰ ਇੱਕ ਚੀਜ਼ ਸਾਡੀ ਆਉਂਦੀ ਹੈ ਜਿਸ ਨਾਲ ਪੂਰਾ ਦੌਰਾ ਖੂਨ ਦਾ ਪੂਰਾ ਦੌਰਾ ਸਾਡੇ ਪੂਰੇ ਸਰੀਰ ਦੇ ਵਿੱਚ ਘੁੰਮਦਾ ਹੈ ਜਿਸ ਨਾਲ ਸਾਡੇ ਬੀਪੀ ਸ਼ੁਗਰ ਹਰ ਇੱਕ ਚੀਜ਼ ਕੋਈ ਵੀ ਸਾਨੂੰ ਬਿਮਾਰੀ ਲੱਗਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ ਜਦੋਂ ਸਾਡਾ ਸ਼ਰੀਰ ਸਾਡੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਪੂਰਾ ਹੋਏਗਾ ਭੰਗੜੇ ਦੇ ਨਾਲ ਸਾਡਾ ਹਾਰਟ ਵੀ ਪੰਪ ਵਧੀਆ ਕਰੇਗਾ ਸਾਡਾ ਬਲੱਡ ਬਲੱਡ ਵੀ ਤਾਂ ਸਾਡੇ ਪੂਰੇ ਸਰੀਰ ਵਿੱਚ ਵਧੀਆ ਤਰੀਕੇ ਨਾਲ ਦੌੜਨਗੇ ਅਤੇ ਜਦੋਂ ਅਸੀਂ ਇੱਦਾਂ ਕਰਾਂਗੇ ਸਾਡਾ ਪੂਰਾ ਸਰੀਰ ਦੌਰਾ ਖੂਨ ਦਾ ਦੌਰਾ ਪੂਰੇ ਸਰੀਰ ਵਿੱਚ ਦੋੜੇਗਾ ਤਾਂ ਸਾਡਾ ਸਰੀਰ ਫੁਰਤੀ ਫੁਰਤੀਲਾ ਹੋ ਜਾਏਗਾ ਅਸੀਂ ਉਦੋਂ ਸਾਰੇ ਕੰਮ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਜੇ ਅਸੀਂ ਇੱਦਾਂ ਕਰਾਂਗੇ ਤਾਂ ਸਾਡਾ ਸਰੀਰ ਵੀ ਵਧੀਆ ਰਹੇਗਾ ਅਤੇ ਉੱਦਾਂ ਵੀ ਵਧੀਆ ਰਹੇਗਾ ਧੰਨਵਾਦ